ਭਾਰਤ ਵਿੱਚ ਭੋਜਨ ਬਹੁਤ ਤਰ੍ਹਾਂ ਦੇ ਬਣਾਏ ਖਾਧੇ ਜਾਂਦੇ ਹਨ ਜਿਨ੍ਹਾਂ ਵਿੱਚ ਇਡਲੀ ਡੋਸਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਪਰੌਂਠੇ ਆਲੂ ਟਿੱਕੀ ਅਤੇ ਇਹਨਾਂ ਵਿੱਚ ਮਸਾਲੇ ਨਮਕ ਹਲਦੀ ਮਿਰਚ ਟਮਾਟਰ ਜੀਰਾ ਇਹ ਆਮ ਪਾਏ ਜਾਂਦੇ ਹਨ ਸਾਊਥ ਵਿੱਚ ਇਡਲੀ ਡੋਸਾ ਬਹੁਤ ਪ੍ਰਸਿੱਧ ਹੈ ਪੰਜਾਬ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਹੁਤ ਜ਼ਿਆਦਾ ਪ੍ਰਸਿੱਧ ਹੈ